ਸਮਾਰਟ ਫੋਨ ਨਾਲ ਜ਼ਿੰਦਗੀ ਕੀ ਜ਼ਿੰਦਗੀ ਨੂੰ ਕਿਵੇਂ ਬਿਹਤਰ ਬਣਾਇਆ ਜਾ ਆ ਹੈ ਅਸੀਂ ਸਮਾਟ ਫੋਨਾਂ ਜਿਵੇਂ ਫੋਰ ਜੀ ਵਿੱਚ ਬਹੁਤ ਹੀ ਜ਼ਿਆਦਾ ਡਾਟਾ ਆਉਂਦਾ ਹੈ ਇਸ ਦੀ ਵਰਤੋਂ ਨਾਲ ਅਸੀਂ ਸਭ ਕੁਛ ਕਰ ਸਕਦੇ ਹਾਂ ਫੋਨ ਵਿੱਚ ਅਸੀਂ ਸੈਡ ਸੌਂਗ ਕੱਢ ਸਕਦੇ ਹਾਂ ਅਤੇ ਕੁਛ ਮਰਜ਼ੀ ਇਸ ਵਿੱਚ ਕੱਢ ਸਕਦੇ ਹਾਂ ਖਬਰਾਂ ਵਗੈਰਾ ਸਾਰਾ ਕੁਛ ਫੋਨ 'ਤੇ ਕੱਢਿਆ ਜਾ ਸਕਦਾ ਹੈ ਫੋਨ ਦੀ ਮਦਦ ਨਾਲ ਅਸੀਂ ਸ ਹਰ ਕਿਸੇ ਦੀ ਮਦਦ ਕਰ ਸਕਦੇ ਹਾਂ ਇਸ ਵਿੱਚ ਲਕੋਸ਼ਨ ਵੀ ਕੱਢ ਸਕਦੇ ਹਾਂ ਸਾਨੂੰ ਹਰ ਸ ਥਾਂ 'ਤੇ ਹਰ ਕਿਸੇ ਜਗ੍ਹਾ 'ਤੇ ਫੋਨ ਦੀ ਜ਼ਰੂਰਤ ਪੈਂਦੀ ਹੈ ਅਤੇ ਸਾਨੂੰ ਫੋਨ ਹਰ ਜਗ੍ਹਾ ਵਰਤਣਾ ਚਾਹੀਦਾ ਹੈ ਇਸ ਦੀ ਵਰਤੋਂ ਹਰ ਜਗ੍ਹਾ ਕੀਤੀ ਜਾਂਦੀ ਹੈ ਸਭ ਲੋਗ ਇਹਨੂੰ ਛੋਟੇ ਬੱਚੇ ਵੀ ਦੇਖਦੇ ਹਨ